ਜਦੋਂ ਕਿਤੇ ਖੁਸ਼ੀ ਮੈਨੂੰ ਮਿਲਦੀ ਹੈ ਤਾਂ ਵੀ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਿਕਲਦਾ ਹੈ ਇਹ ਮੈਨੂੰ ਬੜੀ ਦਿਲਚਸਪ ਅਚਨਚੇਤ ਪਰਮਾਤਮਾ ਵੱਲੋਂ ਬਖਸ਼ਿਸ਼ ਹੈ ਬਈ ਜਦੋਂ ਮੈਨੂੰ ਖੁਸ਼ੀ ਮਿਲਦੀ ਹੈ ਤਾਂ ਵਾਹਿਗੁਰੂ ਦਾ ਜਾਪ ਮੂੰਹ ਚੋਂ ਆਉਂਦਾ ਹੈ ਜਾਂ ਕਿਤੇ ਦੁੱਖ ਦੀ ਘੜੀ ਆਉਂਦੀ ਹੈ ਤਾਂ ਪਰਮਾਤਮਾ ਦਾ ਨਾਮ ਮੂੰਹ ਵਿੱਚੋਂ ਅਚਨਚੇਤ ਨਿਕਲਦਾ ਹੈ ਇਹ ਕੁਦਰਤ ਦੀ ਦੇਣ ਹੈ ਇਹਨਾਂ ਗੱਲਾਂ ਨੂੰ ਅਸੀਂ ਤਨੋ ਮਨੋ ਦਿਲਚਸਪ ਲੋਕਾਂ ਨੂੰ ਵੀ ਦੇਖਦੇ ਹਾਂ ਆਪ ਵੀ ਦੇਖਦੇ ਨੇ